ਮੈਨੂੰ ਮੇਰੇ ਸਕੂਲ ਟਾਈਮ ਤੋਂ ਹੀ ਪੇਂਟਿੰਗ ਵਿੱਚ ਸਿੱਖਿਆ ਮਿਲਦੀ ਆ ਸਾਡੇ ਟੀਚਰ ਨੇ ਸਾਨੂੰ ਪੇਂਟਿੰਗ ਬਾਰੇ ਬਹੁਤ ਕੁਝ ਦੱਸਿਆ ਅਤੇ ਅੱਗੇ ਜਾ ਕੇ ਮੈਂ ਆਪਣੀ ਗਰੈਜੂਏਸ਼ਨ ਦੇ ਵਿੱਚ ਫਾਈਨ ਆਰਟਸ ਸਬਜੈਕਟ ਸਬਜੈਕਟ ਰੱਖਿਆ ਮੇਰੇ ਹਿਸਾਬ ਨਾਲ ਪੇਂਟਿੰਗ ਦੇ ਵਿੱਚ ਸਿਖਲਾਈ ਹੋਣਾ ਬਹੁਤ ਜ਼ਰੂਰੀ ਆ ਸਾਨੂੰ ਸਾਰੇ ਬ੍ਰਸ਼ਿਸ਼ ਬਾਰੇ ਨੌਲੇਜ ਕਿਸ ਤਰ੍ਹਾਂ ਕਲਰ ਕੋਂਬੀਨੇਸ਼ਨਸ ਬਣਾਉਣੇ ਨੇ ਕਿਸ ਤਰ੍ਹਾਂ ਮਤਲਬ ਹਰ ਇੱਕ ਐਂਗਲ ਹੈ ਜੋ ਪ੍ਰੋਪਰ ਬਣਾਉਣਾ ਆ ਇਹ ਚੀਜ਼ ਜਦੋਂ ਵੀ ਅਸੀਂ ਸਿੱਖਾਂਗੇ ਤਾਂ ਹੀ ਪਤਾ ਲੱਗੇਗਾ ਜਦੋਂ ਵੀ ਮੈਂ ਪੇਂਟਿੰਗ ਕਰਦੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਮੇਰੇ ਤੋਂ ਵੀ ਮਤਲਬ ਜੋ ਪੇਂਟਿੰਗ ਸੀ ਜੋ ਐਂਗਲਸ ਹੁੰਦੇ ਸੀਗੇ ਕਿਸੇ ਵੀ ਪਿਕਚਰ ਦੇ ਉਹ ਜ਼ਿਆਦਾ ਕਲੀਅਰ ਅਤੇ ਵਧੀਆ ਨਹੀਂ ਸੀ ਬਣਦੇ ਬਟ ਹੌਲੀ ਹੌਲੀ ਇਸ ਚੀਜ਼ ਦੇ ਵਿੱਚ ਪ੍ਰਫੈਕਸ਼ਨ ਆਉਂਦੀ ਗਈ ਅਤੇ ਹੁਣ ਮੈਂ ਜੋ ਪੋਰਟਰੇਟਸ ਵਗੈਰਾ ਨੇ ਕੈਲੀਗ੍ਰਾਫੀ ਵਗੈਰਾ ਜੋ ਲੈਂਡਸਕੇਪਸ ਵਗੈਰਾ ਬਣਾਉਣੇ ਹੁੰਦੇ ਨੇ ਬਹੁਤ ਜ਼ਿਆਦਾ ਮਤਲਬ ਵਧੀਆ ਬਣਾ ਲੈਂਦੀ ਹਾਂ ਮੇਰੇ ਹਿਸਾਬ ਦੇ ਨਾਲ ਇੱਕ ਸਿਖਲਾਈ ਹੋਣੀ ਇਸ ਚੀਜ਼ ਦੀ ਬਹੁਤ ਜ਼ਰੂਰੀ ਆ ਤਾਂ ਜੋ ਤੁਸੀਂ ਇਸ ਕੰਮ ਦੇ ਵਿੱਚ ਪਰਫੈਕਟ ਹੋ ਸਕੋ